ਪਸ਼ੂਆਂ ਦੇ ਨਾਲ ਸਾਡਾ ਬਹੁਤ ਪਿਆਰ ਹੈ ਬਹੁਤ ਸਾਡਾ ਸਤਿਕਾਰ ਹੈ ਪਸ਼ੂਆਂ ਨੂੰ ਅਸੀਂ ਪਸ਼ੂਆਂ ਦੇ ਸਾ ਮੋਹ ਦੇ ਨਾਲ ਅਸੀਂ ਨਾਂ ਵੀ ਰੱਖੇ ਜਾਂਦੇ ਆ ਅਤੇ ਨਾਂ ਲੈ ਕੇ ਅਸੀਂ ਬੁਲਾਉਂਦੇ ਆ ਤੇ ਪਸ਼ੂਆਂ ਦੇ ਨਾਲ ਹੀ ਜੁੜੇ ਹਾਂ ਅਤੇ ਪਸ਼ੂਆਂ ਨੂੰ ਅਸੀਂ ਨਾਂ ਲੈ ਕੇ ਬੁਲਾਉਂਦੇ ਹਾਂ ਅਤੇ ਪਸ਼ੂ ਬਹੁਤ ਨਾਂ ਲੈ ਕੇ ਜਦੋਂ ਬੁਲਾਉਂਦੇ ਹਾਂ ਅਤੇ ਖੁਸ਼ ਹੁੰਦੇ ਨੇ ਅਤੇ ਆਪਣੇ ਨਾਵਾਂ 'ਤੇ ਉੱਠਦੇ ਨਾ ਅਤੇ ਪਸ਼ੂਆਂ ਦੇ ਨਾਲ ਸਾਡਾ ਸੋਹਣਾ ਟਾਈਮ ਪਾਸ ਹੋ ਜਾਂਦਾ ਪਸ਼ੂਆਂ ਦੇ ਵਿੱਚ ਹੀ ਸਾਡੀ ਜਿੰਦ ਜਾਨ ਹੈ ਅਤੇ ਪਸ਼ੂਆਂ ਦੇ ਨਾਲ ਹੀ ਸਾਨੂੰ ਤਾਂ ਬੰਦਿਆਂ ਨਾਲੋਂ ਪਿਆਰੇ ਪਸ਼ੂ ਲੱਗਦੇ ਨੇਗੇ ਜਾਨਵਰ ਪਸ਼ੂ ਆ ਨਾ ਜਿਹੜੇ ਅਤੇ ਉਹ ਸਾਨੂੰ ਬਹੁਤ ਪਿਆਰੇ ਲੱਗਦੇ ਨੇ ਉਹਨਾਂ ਦੀ ਅਸੀਂ ਦੇਖਭਾਲ ਕਰਨੀ ਨੀਰਾ ਚਾਰਾ ਪਾਉਣਾ ਪਾਣੀ ਪਿਲਾਉਣਾ ਗਰਮੀਆਂ ਦੇ ਵਿੱਚ ਜ਼ਿਆਦਾ ਟਾਈਮ ਪਾਣੀ ਪਿਲਾਉਣਾ ਅਤੇ ਦੇਖਭਾਲ ਕਰਨੀ ਪੈਂਦੀ ਹੈ ਨਹਾ ਕੇ ਅਤੇ ਬੜੀਆਂ ਸ਼ਿੰਗਾਰ ਕੇ ਰੱਖਣੇ ਪੈਂਦੇ ਆ ਅਤੇ ਮੋਹ ਪਿਆਰ ਇਹਨਾਂ ਦਾ ਪੂਰੇ ਕਰਨੇ ਪੈਂਦੇ ਆ ਅਤੇ ਦੁੱਧ ਪਾਣੀ ਪੀ ਕੇ ਅਤੇ ਫਿਰ ਅਸੀਂ ਪਹਿਲੀ ਕੇ ਆਪਣਾ ਆਨੰਦ ਮਾਣਦੇ ਹਾਂ ਅਤੇ ਇਹ ਪਸ਼ੂਆਂ ਦੇ ਵਿੱਚੋਂ ਸਾਨੂੰ ਬਹੁਤ ਕੁਛ ਮਿਲਦਾ ਅਤੇ ਬਹੁਤ ਹੀ ਸਾਨੂੰ ਪਿਆਰ ਸਤਿਕਾਰ ਆ